ਅੰਮ੍ਰਿਤ ਸਿੰਘ ਗੁਰਪ੍ਰੀਤ ਸਿੰਘ ਹਰਜੋਤ ਸਿੰਘ ਮਨਦੀਪ ਕੌਰ ਸੁਖਵਿੰਦਰ ਸਿੰਘ ਨਵਜੋਤ ਕੌਰ ਪਰਮਜੀਤ ਸਿੰਘ ਜਸਪਾਲ ਸਿੰਘ ਕੁਲਵਿੰਦਰ ਸਿੰਘ ਰਣਜੀਤ ਕੌਰ ਰਵਿੰਦਰ ਕੌਰ ਮਲਹੋਤਰਾ ਅਨਮੋਲ ਚੋਪੜਾ ਨਮਨ ਕਪੂਰ ਸੰਜੀਵ ਬਖਸ਼ੀ ਅਸ਼ੋਕ ਖੰਨਾ ਕਿਰਨ ਆਨੰਦ ਵਿਨੇ ਮਹਿਤਾ ਦੀਪਕ ਖੋਸਲਾ ਮੋਹਨ ਸ਼੍ਰੀਵਾਸਤਵ ਮਨੋਜ ਜੈਨ ਰਮੇਸ਼ ਅਰੋੜਾ ਮੋਨਿਕਾ ਅਰੋੜਾ ਗੌਰਵ ਸੈਬੀ ਵਿਪਨ ਨੰਗਿਆ ਸੁਮੀਤ ਬਰ ਬੱਗਾ ਅਨਿਕੇਤ ਸੂਦ ਰਾਜੀਵ ਸਹਿਨੀ ਵਿਪਨ ਸਟੰਡਨ ਸੁਨੀਲ ਚਬੜਾ ਤਨਵੀ ਭੱਲਾ ਤਜਿੰਦਰ ਸਿੰਘ ਰੰਧਾਵਾ ਜਸਪ੍ਰੀਤ ਸਿੰਘ ਚਹਿਲ ਹਰਿੰਦਰ ਸਿੰਘ ਗਿੱਲ ਸੁਖਚੈਨ ਸਿੰਘ ਢਿੱਲੋਂ ਗੁਰਸ਼ਰਨ ਸਿੰਘ ਸੋਹਲ ਮਨਪ੍ਰੀਤ ਕੌਰ ਸੰਧੂ ਸੰਦੀਪ ਸਿੰਘ ਸੰਧੂ ਅਰਸ਼ਦੀਪ ਕੌਰ ਬੈਂਸ ਰ ਰਵਜੀਤ ਸਿੰਘ ਚਾਹਲ ਸਮਰਵੀਰ ਸਿੰਘ ਢਿੱਲੋਂ ਸੰਤੋਖ ਦਾਸ ਗਿਆਨ ਚੰਦ ਰਾਮ ਸਿੰਘ ਰਵੀਦਾਸੀ ਗੁਲਸ਼ਨ ਚੋਹਲ ਸੁਨੀਲ ਬਾਗਰੀ ਜਸਪ੍ਰੀਤ ਰਾਮ ਅਵਨੀਸ਼ ਲਾਲ ਹਰੀ ਕ੍ਰਿਸ਼ਨ ਨ ਨਵਨਟ ਮਨੋਜ ਕੁਮਾਰ ਕੁਲਦੀਪ ਦਾਸ ਧੰਨਵਾਦ